ਮੈਂ ਮੈਂ ਆਪਣੀਆਂ ਤਸਵੀਰਾਂ ਮੀਡੀਆ ਆਪਣੇ ਪੋਸਟ ਕਰਦਾ ਜਿਵੇਂ ਕੀ ਫੇਸਬੁੱਕ ਇੰਸਟਾਗਰਾਮ ਵਟਸਐਪ ਦੇ ਜਾਣੀ ਕਿ ਪਲੇਟਫਾਰਮ 'ਤੇ ਕਰਦਾ ਹਾਂ ਕਿਉਂਕਿ ਲੋਕਾਂ ਨੂੰ ਅ ਕਿਉਂਕਿ ਕਿਉਂਕਿ ਮੈਂ ਦੱਸਣਾ ਚਾਹੁੰਦਾਂ ਕਿ ਲੋਕਾਂ ਵਿੱਚ ਸੱਚਾਈ ਕਿਸ ਤਰ੍ਹਾਂ ਪੈਦਾ ਕੀਤੀ ਜਾਵੇ ਕਿ ਵਧੀਆ ਕਿੱਦਾਂ ਲੱਗਿਆ ਜਾਵੇ ਜਾਣੀ ਕਿ ਵਧੀਆ ਪੋਸਟ ਪਾ ਕੇ ਲੋਕਾਂ ਨੂੰ ਸੱਚਾਈ ਕੀਤਾ ਜਾਵੇ ਵਧੀਆ ਉਹਨਾਂ ਦੀ ਸੋਚ ਬਣੇ ਇਸ ਕਰਕੇ ਮੈਂ ਆਪਣੀਆਂ ਫੋਟੋਆਂ ਪਾਉਂਦਾ ਆ ਫੋਟੋ ਇਸ ਕਰਕੇ ਪਾਉਂਦਾ ਕਿ ਪਤਾ ਲਗ ਲੱਗੇ ਵੀ ਕਿਸ ਤਰ੍ਹਾਂ ਹੈ ਯਾਨੀ ਕਿ ਵਧੀਆ ਲੱਗੇ ਯਾਨੀ ਕਿ ਕੋਈ ਪੋਸਟ ਏ ਇਸ ਤਰ੍ਹਾਂ ਪਾਉਂਦਾ ਹੈ ਕਿਉਂਕਿ ਕੋਈ ਹੋਮ ਕੋਈ ਕਿਸੇ ਦੀ ਮਦਦ ਕ ਜਿਸ ਤਰ੍ਹਾਂ ਮੈਂ ਕਿਸੇ ਦੀ ਕੋਈ ਮਦਦ ਕਰਦਾ ਹਾਂ ਕਿ ਪੋਸਟ ਇਹਨਾਂ ਕਰਕੇ ਲੋਕਾਂ ਨੂੰ ਪਤਾ ਲੱਗਿਆ ਵੀ ਅਸੀਂ ਕਿਸੇ ਦੀ ਵੱਧ ਤੋਂ ਵੱਧ ਮਦਦ ਕਰੀਏ